ਅਗ ਜੇ ਗੱਲ ਕੀਤੀ ਜਾਵੇ ਸਾਡੇ ਜ਼ਿਲ੍ਹੇ ਵਿੱਚ ਤਿਉਹਾਰ ਦੀ ਸਾਡੇ ਜ਼ਿਲ੍ਹੇ ਵਿੱਚ ਬਹੁਤ ਹੀ ਪ੍ਰਸਿੱਧ ਹੋਏ ਹਨ ਸਥਾਨ ਹਨ ਜੋ ਕਿ ਸੱਭਿਆਚਾਰਕ ਪਰੰਪਰਾ ਵਿੱਚ ਮਨਾਇਆ ਜਾਂਦਾ ਹੈ ਸਾਲ 'ਚ ਇੱਕ ਵਾਰੀ ਮਨਾਉਂਦੇ ਹਨ ਹਰੇਕ ਸਾਲ ਭਾਈਚਾਰੇ ਜਿੱਥੇ ਸਭ ਮਿਲੇ ਵਰਤਦੇ ਹਨ ਜੋ ਕਿ ਸਾਡੇ ਇੱਥੇ ਨੇੜੇ ਜਗ੍ਹਾ ਹੈ ਨਵਾਂਸ਼ਹਿਰ ਵਿੱਚ ਰਾਜਾ ਸਾਹਿਬ ਜੋ ਕਿ ਅਗਸਤ ਸਤੰਬਰ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਬਹੁਤ ਹੀ ਭੀੜ ਭੜੱਕਾ ਹੁੰਦਾ ਸਥਾਨ ਹੈ ਜੋ ਕਿ ਉੱਥੇ ਗੁਰੂ ਦਾ ਲੰਗਰ ਪੰਜਾਂ ਪੀਰਾਂ ਬਾਬਿਆਂ ਦੀ ਜਗ੍ਹਾ ਹੈ ਉੱਥੇ ਬਹੁਤ ਹੀ ਰਸ਼ ਹੁੰਦਾ ਹੈ ਅਤੇ ਗੁਰਦੁਆਰੇ ਵਿੱਚ ਲੰਗਰ ਲੱਗਦਾ ਹੈ ਸਾਡੇ ਨੇੜੇ ਇੱਥੇ ਟਿੱਬੀ ਸਾਹਿਬ ਵੀ ਹਨ ਇਸ ਵਿੱਚ ਵੀ ਬਹੁਤ ਹੀ ਸਾਲ 'ਚ ਇੱਕ ਵਾਰ ਮੇਲਾ ਤਕੜਾ ਲੱਗਦਾ ਹੈ ਵਿਸਾਖੀ ਵਿਸਾਖੀ ਦੇ ਮ ਮੇਲੇ ਵਿੱਚ ਇਸ ਕਾਰਨ ਬਹੁਤ ਹੀ ਉਰੇ ਰਸ਼ ਹੁੰਦਾ ਹੈ ਅਤੇ ਮੱਥਾ ਟੇਕਣ ਨੂੰ ਵੀ ਨਹੀਂ ਜਗ੍ਹਾ ਹੁੰਦੀ ਇੰਨਾ ਰਸ਼ ਹੁੰਦਾ ਹੈ